ਹੈਲੋ ਹਾਂਜੀ ਮੇਰੀ ਸਿਮਰਨਪ੍ਰੀਤ ਜੀ ਨਾਲ ਗੱਲ ਹੋ ਰਹੀ ਆ ਹਾਂਜੀ ਮੈਂ ਨਾ ਉੱਥੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਘੁੰਮਣ ਆਉਣਾ ਤਿੰਨ ਦਿਨ ਵਾਸਤੇ ਤਾਂ ਮੈਂ ਵੀ ਮੈਂ ਤਿੰਨ ਦਿਨਾਂ 'ਚ ਸਾਰਾ ਕੁਛ ਘੁੰਮ ਲਵਾਂਗੀ ਕਿਆ ਏ ਟਾਈਮ ਠੀਕ ਹੈਗਾ ਵਾ ਇੰਨਾਂ ਟਾਈਮ ਅੱਛਾ ਠੀਕ ਆ ਅਤੇ ਮੇਰਾ ਫਿਰ ਇਸ ਕਰਕੇ ਤੁਸੀਂ ਸਲੋਟ ਬੁੱਕ ਕਰ ਲਓ ਤਾਂ ਕਿ ਮੈਂ ਫਿਰ ਆਵਾਂ ਅਤੇ ਮੈਂ ਸਭ ਕੁਛ ਇੰਜੋਏ ਕਰ ਸਕਾਂ